ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਕਿਰਨਦੀਪ ਕੋਰ ਬੋਲ ਰਹੀ ਹਾਂ ਮੈਂ ਤੁਹਾਡੇ ਤੋਂ ਥੋੜ੍ਹੇ ਦਿਨ ਪਹਿਲਾਂ ਹੀ ਆਪਣਾ ਇੱਕ ਮੋਬਾਇਲ ਖਰੀਦਿਆ ਸੀ ਅਤੇ ਉਹ ਤੁਹਾਡਾ ਮੁਬਾਇਲ ਜੋ ਹੈ ਤੁਹਾਡੀ ਸ਼ੋਪ ਤੋਂ ਮੈਂ ਲਿਆ ਸੀ ਔਰ ਉਹ ਉਹਦੇ ਕੁਆਲਟੀ ਬਿਲਕੁਲ ਖਰਾਬ ਨਿਕਲੀ ਹੈ ਕਿਉਂਕਿ ਉਹ ਚੰਗੀ ਤਰ੍ਹਾਂ ਵਰਕ ਹੀ ਨਹੀਂ ਕਰ ਰਿਹਾ ਉਹਦੇ 'ਚ ਬਹੁਤ ਸਾਰੇ ਐਰਰਸ ਆ ਰਹੇ ਹੈ ਜਦੋਂ ਮੈਂ ਕਿਤੇ ਡੇਟਾ ਸਰਚ ਕਰਦੀ ਹਾਂ ਦੈਨ ਇੰਟਰਨੈਟ ਵੀ ਨਹੀਂ ਚਲਦਾ ਔਰ ਪਲੱਸ ਉਹਦੀ ਮੈਨੂੰ ਨਾ ਕੋਲਿੰਗ ਦੇ ਵਿੱਚ ਵੀ ਕਲੈਰਟੀ ਨਹੀਂ ਹੁੰਦੀ ਇੰਟਰਫੇਰੇਂਸ ਬਹੁਤ ਜ਼ਿਆਦਾ ਆਉਂਦੀ ਹੈ ਕੋਲ ਦੇ ਦੋਰਾਨ ਓਕੇ ਅਤੇ ਇਹ ਕਿੰਨੇ ਕੁ ਦਿਨਾਂ ਦਾ ਪਰੋਸੈਸ ਹੈ ਕਿਉਂਕਿ ਮੈਨੂੰ ਤਾਂ ਇਮੀਡੇਟ ਫੋਨ ਤੁਹਾਡੇ ਤੋਂ ਖਰੀਦਿਆ ਸੀ ਤਾਂ ਕੀ ਮੈਂ ਵਧੀਆ ਤਰੀਕੇ ਨਾਲ ਚਲਾ ਸਕਾਂ ਪਰ ਇਹ ਮੈਨੂੰ ਲੱਗਦਾ ਏ ਕੀ ਅੱਛੀ ਤਰ੍ਹਾਂ ਵਰਕ ਨਹੀਂ ਕਰ ਰਿਹਾ ਮੈਨੂੰ ਇਹ ਦੱਸਿਓ ਵੀ ਤੁਸੀਂ ਮੇਰਾ ਪੁਰਾਣਾ ਫੋਨ ਹੀ ਜ ਚੇਂਜ ਕਰੋਗੇ ਚੇਂਜ ਕਰੋਗੇ ਜਾਂ ਮੈਨੂੰ ਨਵਾਂ ਦਓਗੇ ਠੀਕ ਹੈ ਜੀ ਮੈਂ ਉਮੀਦ ਕਰਦੀ ਹਾਂ ਕਿ ਅੱਗੇ ਤੋਂ ਜਿਹੜਾ ਮੇਰਾ ਮ ਮੋਬਾਇਲ ਹੋਵੇਗਾ ਉਹਦੇ ਚ ਇਹ ਸਾਰੀਆਂ ਦਿੱਕਤ ਪ੍ਰੇਸ਼ਾਨੀਆਂ ਨਹੀਂ ਦੇਖਣੀਆਂ ਪੈਣਗੀਆਂ ਓਕੇ ਜੀ ਓਕੇ ਜੀ ਠੀਕ ਹੈ ਠੀਕ ਹੈ